ਦਿਹਾਤੀ ਖੇਤਰਾਂ ਮੁੱਖ ਤਕਨੋਲਜੀ ਚੁਣੌਤੀਆਂ ਦਾ ਬਹੁਤ ਹਨ ਜਿਵੇਂ ਕਿ ਜਿਵੇਂ ਕਿ ਪਿੰਡਾਂ ਵਿੱਚ ਅਜੇ ਅਜਿਹੇ ਪਿੰਡ ਕਾਫੀ ਹਨ ਜਿਨ੍ਹਾਂ 'ਚ ਆਵਾਜਾਈ ਦਾ ਸਾਧਨ ਨਹੀਂ ਹੈਗਾ ਅਤੇ ਸੈਕਿੰਡ ਨੰਬਰ ਮੋਬਾਇਲ ਟਾਵਰ ਅਤੇ ਫਾਈਵ ਜੀ ਦੀ ਕੋਈ ਸੁਵਿਧਾ ਨਹੀਂ ਹੈਗੀ ਅਤੇ ਟਾਵੇਂ ਟਾਵੇਂ ਬਰੋਡਬੈਂਡ ਨੈਟ ਬੀ ਐੱਸ ਐੱਨ ਐੱਲ ਨਾਲ ਵੀ ਉਹਨਾਂ ਦੇ ਆਪਣੇ ਕਨੈਕਸ਼ਨ ਦਿੱਤੇ ਹਨ ਅਤੇ ਥਰਡ ਔਪਸ਼ਨ ਇਹ ਵੀ ਆ ਕਿ ਅਸੀਂ ਜਿਹੜੇ ਆਪਣੇ ਪੜ੍ਹੇ ਲਿਖੇ ਨੌਜਵਾਨ ਮੁੰਡੇ ਹਾਂ ਉਹ ਚੰਡੀਗੜ੍ਹ ਜਿਵੇਂ ਕੋਈ ਬਾਰ ਹੋ ਗਏ ਜਾਂ ਪਿਜ਼ਾ ਹੱਟ ਮੈਕਡੋਨਰ ਉਹ ਚੰਡੀਗੜ੍ਹ ਰਹਿ ਜਾਂਦੇ ਪਿੰਡ 'ਚ ਇਹ ਜਿਹੀ ਕੋਈ ਨਾ ਤਾਂ ਕੋਈ ਮੈਕਡੋਨਲ ਬੋਲਦਾ ਨਾ ਹੀ ਪਿਜ਼ਾ ਬਿਸਟਾ ਕਾਸਾ ਸੋ ਸੋ ਪਿੰਡ ਦੇ ਲੋਕ ਬਹੁਤ ਹੀ ਦੂਰ ਹਨ ਇਨਾਂ ਗੱਲਾਂ ਤੋਂ ਅਤੇ ਉਹਨਾਂ ਨੂੰ ਕਦੇ ਉਹਨਾਂ ਨੇ ਅੱਜ ਤੱਕ ਕਦੇ ਦੇਖਿਆ ਕੋਈ ਵੀ ਪਿੰਡ ਦਾ ਬੰਦਾ ਸਾਬੇ 'ਚ ਜਾ ਕੇ ਫੂਡ ਔਡਰ ਨਹੀਂ ਕਰ ਸਕਦਾ